ਹੈਲੋ ਹਾਂਜੀ ਹਾਂਜੀ ਤੁਸੀਂ ਕੌਣ ਅੱਛਾ ਜੀ ਹਾਂਜੀ ਹਾਂਜੀ ਜ਼ਰੂਰ ਜੀ ਹਾਂਜੀ ਤੁਸੀਂ ਹਾਂਜੀ ਜ਼ਰੂਰ ਤੁਸੀਂ ਅਗਲੇ ਮਹੀਨੇ ਆਉਣਾ ਚਾਹੁੰਦੇ ਹੋ ਜਾ ਇਸ ਮਹੀਨੇ ਜੀ ਠੀਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਦਸੰਬਰ ਦੇ ਮਹੀਨੇ 'ਚ ਜੇ ਤੁਸੀਂ ਫਤਿਹਗੜ੍ਹ ਸਾਹਿਬ ਆਉਂਦੇ ਹੋ ਤਾਂ ਤੁਹਾਨੂੰ ਦਰਸ਼ਨ ਵੀ ਬਹੁਤ ਵਧੀਆ ਹੋ ਜਾਣਗੇ 'ਤੇ ਰਹੀ ਮੌਸਮ ਦੀ ਗੱਲ ਮੌਸਮ ਦੀ ਬਹੁਤ ਵਧੀਆ ਰਹੂਗਾ ਜੀ ਹਾਲੇ ਧੁੰਦਾ ਸਟਾਰਟ ਨਹੀਂ ਹੋਈਆਂ ਜਨਵਰੀ ਦੇ ਵਿੱਚ ਧੁੰਦ ਪੈ ਜਾਂਦੀ ਹੈ ਜੀ ਅਤੇ ਤੁਹਾਨੂੰ ਮੇ ਬੀ ਟਰੈਫਿਕ ਦਾ ਵੀ ਸਾਹਮਣਾ ਕਰਨਾ ਪਵੇ ਟਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਹੈ ਅਤੇ ਤੁਸੀਂ ਚੰਗੀ ਤਰ੍ਹਾਂ ਫਿਰ ਦਰਸ਼ਨ ਵੀ ਨਹੀਂ ਕਰ ਪਾਉਗੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਵੀ ਨੇ ਜੇ ਤੁਸੀਂ ਦਸੰਬਰ ਦੇ ਵਿੱਚ ਆਉਗੇ ਤਾਂ ਤੁਹਾਨੂੰ ਪਤਾ ਹੀ ਹੋਣਾ ਜੀ ਸ਼ਹੀਦੀ ਜੋੜ ਮੇਲਾ ਇੱਥੇ ਪ੍ਰਮੁੱਖ ਆਪਣੇ ਫਤਿਹਗੜ੍ਹ ਸਾਹਿਬ ਦੇ ਵਿੱਚ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀਗੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਹਾਂਜੀ ਉਸ ਸ਼ਹੀਦੀ ਜੋੜ ਮੇਲਾ ਸਟਾਰਟ ਹੋ ਰਿਹਾ ਜੀ ਦਸੰਬਰ ਦੇ ਵਿੱਚ ਅਤੇ ਤੁਸੀਂ ਉਹਦਾ ਵੀ ਹਿੱਸਾ ਬਣ ਸਕਦੇ ਹੋ ਅਤੇ ਤੁਹਾਨੂੰ ਬਹੁਤ ਵਧੀਆ ਦਰਸ਼ਨ ਵੀ ਹੋ ਜਾਣਗੇ ਅਤੇ ਤੁਸੀਂ ਸੰਗਤ ਦੇ ਦਰਸ਼ਨ ਵੀ ਕਰੋਗੇ ਬਹੁਤ ਕਨੇਡਾ ਤੋਂ ਤਾਂ ਜੀ ਬਹੁਤ ਸੰਗਤ ਆਉਂਦੀ ਆਂ ਉਹ ਕੈਨੇਡਾ ਅਮੈਰੀਕਾ ਤੋਂ ਜਿੱਦਾ ਮਤਲਵ ਕਿ ਜਿਹੜੀ ਸੰਗਤ ਆ ਉਹ ਦਸੰਬਰ ਦੇ ਵਿੱਚ ਹੀ ਆਉਂਦੇ ਨਾਲੇ ਮੌਸਮ ਵੀ ਖੁੱਲ੍ਹਾ ਹੁੰਦਾ ਹੈ ਇੱਨੀ ਠੰਡ ਵੀ ਨਹੀਂ ਹੁੰਦੀ ਅਤੇ ਤੁਹਾਡੇ ਦਰਸ਼ਨ ਵੀ ਬਹੁਤ ਵਧੀਆ ਹੋ ਜਾਂਦੇ ਨੇ ਹਾਂਜੀ ਹਾਂਜੀ ਜ਼ਰੂਰ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪ੍ਰਬੰਧ ਹੁੰਦਾ ਜੀ ਮੌਸਮ ਨੂੰ ਦੇਖਦੇ ਹੋਏ ਤੁਹਾਨੂੰ ਸਭ ਚੀਜ਼ਾਂ ਦੀ ਫੈਸਿਲਿਟੀ ਮਿਲ ਜੂਗੀ ਬਲੈਂਕਡ ਜੋ ਵੀ ਉਸ ਟਾਈਮ ਮੌਸਮ ਦੇ ਅਕੋਡਿੰਗ ਬਲੈਂਕਡ ਵਗੈਰਾ ਰਜਾਈਆਂ ਜੋ ਵੀ ਤੁਹਾਨੂੰ ਚਾਹੀਦੇ ਆ ਸਭ ਕੁਝ ਅਵੇਲੇਬਲ ਹੋ ਜੂਗਾ ਜੀ ਅਤੇ ਤਾਂ ਹੀ ਮੈਂ ਤੁਹਾਨੂੰ ਕਿਹਾ ਸੀ ਵੀ ਦਸੰਬਰ ਦੇ ਵਿੱਚ ਆਉਣਾ ਤੁਹਾਨੂੰ ਜ਼ਿਆਦਾ ਠੀਕ ਰਹੂਗਾ ਕਿਉਂਕਿ ਤੁਹਾਨੂੰ ਸਾਰੇ ਤਰ੍ਹਾਂ ਦੀ ਫੈਸਿਲਿਟੀ ਮਿਲ ਜੂਗੀ ਹਾਂਜੀ ਹਾਂਜੀ ਫਤਿਹ ਤੁਸੀਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੋਂ ਵੀ ਨਾ ਤੁਸੀਂ ਮੋਤੀ ਮਹਿਰਾ ਗੁਰਦੁਆਰਾ ਸਾਹਿਬ ਉਸ ਤੋਂ ਬਿਨਾਂ ਰੋਜ਼ਾ ਸ਼ਰੀਫ ਵੀ ਆਪਣੇ ਉੱਥੇ ਰੋਜਾ ਸ਼ਰੀਫ ਹੈ ਜੀ ਆਪਣੇ ਮੁਸਲਮਾਨਾਂ ਦੀ ਜਗ੍ਹਾ ਬਣੀ ਹੋਈ ਹੈ ਜੀ ਉਹ ਤੋਂ ਬਿਨਾਂ ਹਿਸਟੋਰੀਕਲ ਪੈਲਸ ਹੈ ਜੀ ਆਮ ਖਾਸ ਬਾਗ ਇਹ ਚੀਜ਼ਾਂ ਨਾ ਇਹ ਦਸੰਬਰ 'ਚ ਤੁਹਾਨੂੰ ਦੇਖਣੀਆਂ ਵਧੀਆ ਕਿਉਂਕਿ ਖੁੱਲ੍ਹਾ ਮੌਸਮ ਹੁੰਦਾ ਹੈ ਜੀ ਇੱਨੀ ਜ਼ਿਆਦਾ ਉਹ ਨਾ ਗਰਮੀ ਹੁੰਦੀ ਆ ਨਾ ਜ਼ਿਆਦਾ ਠੰਡ ਹੁੰਦੀ ਆ ਅਤੇ ਠੀਕ ਹੁੰਦਾ ਮੌਸਮ ਤੁਸੀਂ ਇੱਕੋਂ ਇਕ ਤਰ੍ਹਾਂ ਨਾਲ ਘੁੰਮਣ ਵਾਲਾ ਮੌਸਮ ਹੁੰਦਾ ਜੀ ਤੁਸੀਂ ਵਧੀਆ ਇੰਜੋਏ ਕਰ ਸਕਦੇ ਹੋ ਅਤੇ ਇੱਥੇ ਦਾ ਖਾਣਾ ਪਾਣੀ ਵੀ ਇੰਜੋਏ ਕਰ ਸਕਦੇ ਹੋ ਲੰਗਰ ਪਾਣੀ ਵੀ ਬਹੁਤ ਲੰਗਰ ਲੱਗਦੇ ਨੇ ਉਸ ਟਾਈਮ ਤਾਂ ਜੀ ਅਤੇ ਤੁਹਾਨੂੰ ਸੇਵਾ ਕਰਕੇ ਵੀ ਵਧੀਆ ਲੱਗੇਗਾ ਦਰਸ਼ਨ ਕਰਕੇ ਵੀ ਵਧੀਆ ਲੱਗੇਗਾ ਜੀ ਹਾਂਜੀ ਜ਼ਰੂਰ ਜਦੋਂ ਵੀ ਤੁਸੀਂ ਆਉਣਾ ਹੋਇਆ ਤਾਂ ਮੈਨੂੰ ਇਸ ਨੰਬਰ 'ਤੇ ਕੋਲ ਕਰ ਲਿਓ ਜੀ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ